ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਾਨਸੀ ਹੈ ਮੈਂ ਦਸ ਦਿਨਾਂ ਪਹਿਲੇ ਤੁਹਾਡੀ ਕੰਪਨੀ ਤੋਂ ਇੱਕ ਨਵਾਂ ਸਮਾਰਟਫੋਨ ਆਰਡਰ ਕੀਤਾ ਸੀ ਜਿਸਦਾ ਆਰਡਰ ਨੰਬਰ ਹੈ ਤਿੰਨ ਸੱਤ ਚਾਰ ਪੰਜ ਛੇ ਜਦ ਮੈਂ ਆਰਡਰ ਕੀਤਾ ਸੀ ਤਾਂ ਮੈਨੂੰ ਦੱਸਿਆ ਗਿਆ ਸੀ ਕਿ ਮੈਨੂੰ ਇਹ ਆਰਡਰ ਅੱਠ ਤੋਂ ਦਸ ਦਿਨਾਂ ਦੇ ਅੰਦਰ ਮੇਰੇ ਦਿੱਤੇ ਗਏ ਐਡਰੈਸ ਦੇ ਉੱਤੇ ਪਹੁੰਚਾ ਦਿੱਤਾ ਜਾਵੇਗਾ ਪਰ ਮੈਨੂੰ ਖੇਦ ਹੈ ਕਿ ਦਸ ਦਿਨ ਪੂਰੇ ਹੋਣ ਆਏ ਨੇ ਅਤੇ ਨਾ ਤਾਂ ਮੈਨੂੰ ਮੇਰਾ ਆਰਡਰ ਮਿਲਿਆ ਅਤੇ ਨਾ ਹੀ ਮੈਨੂੰ ਦੱਸਿਆ ਗਿਆ ਕਿ ਮੈਨੂੰ ਮੇਰਾ ਆਰਡਰ ਕਿੰਨੇ ਕੁ ਚਿਰ ਤੱਕ ਮਿਲ ਜਾਵੇਗਾ ਅਤੇ ਨਾ ਹੀ ਕੰਪਨੀ ਵੱਲੋਂ ਮੈਨੂੰ ਕੋਈ ਵਧੇਰੇ ਜਾਣਕਾਰੀ ਦਿੱਤੀ ਗਈ ਹੈ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਕਿਉਂਕਿ ਮੈਂ ਇਹ ਸਮਾਰਟਫੋਨ ਆਪਣੇ ਪੁੱਤਰ ਨੂੰ ਉਹਦੇ ਆਉਣ ਵਾਲੇ ਜਨਮਦਿਨ ਦੇ ਤੋਹਫੇ ਦੇ ਤੌਰ 'ਤੇ ਦੇਣਾ ਚਾਹੁੰਦੀ ਸਾਂ ਮੇਰਾ ਪੁੱਤਰ ਅਗਲੇ ਦਸ ਦਿਨਾਂ ਵਿੱਚ ਵਿਦੇਸ਼ ਨੂੰ ਜਾ ਰਿਹਾ ਮੈਂ ਚਾਹੁੰਦੀ ਸਾਂ ਕਿ ਮੈਂ ਉਸ ਦੇ ਜਾਣ ਤੋਂ ਪਹਿਲਾਂ ਉਸਨੂੰ ਇਹ ਤੋਹਫਾ ਦੇਵਾਂ ਉਹ ਬਹੁਤ ਖੁਸ਼ ਹੋਵੇਗਾ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਕਿਉਂਕਿ ਮੈਂ ਆਪਣੀ ਇੱਕ ਬਹੁਤ ਹੀ ਪਿਆਰੀ ਸਹੇਲੀ ਦੇ ਕੋਲੋਂ ਤੁਹਾਡੀ ਕੰਪਨੀ ਦੀ ਵਧੀਆ ਨੀਤੀਆਂ ਦੇ ਬਾਰੇ ਸੁਣਿਆ ਸੀ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਅਤੇ ਮੈਨੂੰ ਦੱਸੋ ਕਿ ਮੈਨੂੰ ਮੇਰਾ ਆਰਡਰ ਕਿੰਨੇ ਕੁ ਚਿਰ ਤੱਕ ਮਿਲ ਜਾਵੇਗਾ ਅਤੇ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ ਧੰਨਵਾਦ